ਤੁਸੀਂ ਤਨੂੰ ਈਵੈਂਟ ਪਲੈਨਰ 'ਤੇ ਫ਼ੋਨ ਕਰਦੇ ਹੋ ਜੀ ਮੈਨੂੰ ਤੁਹਾਡਾ ਨੰਬਰ ਮੇਰੀ ਦੀਦੀ ਨੇ ਦਿੱਤਾ ਮੈਨੂੰ ਮਤਲਬ ਮਹਿੰਦੀ ਬਾਰੇ ਮਤਲਬ ਈਵੈਂਟ ਪਲੇਨ ਕਰਨਾ ਸੀ ਤੁਹਾਡੇ ਉੱਥੇ ਤੁਹਾਡੇ ਮਤਲਬ ਹੋ ਸਕਦਾ ਹੈ ਅੱਛਾ ਮਤਲਬ ਇਹਦੇ ਮਤਲਬ ਕਿੰਨਾਂ ਰੇਂਜ ਹੋ ਸਕਦਾ ਹੈ ਡੈਕੋਰੇਸ਼ਨ ਵਗੈਰਾ ਵਧੀਆ ਹੋਣੀ ਚਾਹੀਦੀ ਹੈ ਅਤੇ ਖਾਣ ਖਾਣਾ ਵਗੈਰਾ ਵਧੀਆ ਹੋਣਾ ਚਾਹੀਦਾ ਹੈ ਅਤੇ ਅਸੀਂ ਕਿੱਥੇ ਮਿਲ ਸਕਦੇ ਹੈ ਮਤਲਬ ਤੁਹਾਡਾ ਐਡਰੈਸ ਕਿੱਥੇ ਹੈ ਅੱਛਾ ਮਤਲਬ ਖਾਣਾ ਵਗੈਰਾ ਵਧੀਆ ਹੁੰਦਾ ਹੈ ਨਾ ਕੋਆ ਕੁਆਲਟੀ ਕਿੱਦਾਂ ਦੀ ਹੈ ਤੁਹਾਡੇ ਬਾਰੇ ਤਾਂ ਮੈਂ ਬਹੁਤ ਕੁਛ ਸੁਣਿਆ ਹੈ ਕਿ ਮਤਲਬ ਬਹੁਤ ਵਧੀਆ ਹੁੰਦਾ ਹੈ ਮਤਲਬ ਉੱਥੇ ਪਲੇਸ ਵਗੈਰਾ ਵੀ ਬਹੁਤ ਅੱਛਾ ਜੀ ਅਤੇ ਉੱਥੇ ਫੋਟੋ ਵਗੈਰਾ ਵੀ ਖਿੱਚਣ ਸਜਾਵਟ ਵਗੈਰਾ ਬਹੁਤ ਵਧੀਆ ਹੋਣੀ ਚਾਹੀਦੀ ਹੈ ਕਿ ਤਾਂ ਕਹਿਣ ਕਿ ਸਹੀ ਬਹੁਤ ਵਧੀਆ ਹੈ ਹਾਂ ਫਿਰ ਮਤਲਬ ਖਾਣ ਪੀਣ ਦਾ ਵੀ ਦੇਖ ਲਿਓ ਕੁਛ ਖ਼ਰਾਬ ਨਾ ਹੋਵੇ ਚਾਰ ਪੰਜ ਸੌ ਰਿਸ਼ਤੇਦਾਰ ਮਤਲਬ ਆਉਣਗੇ ਇੰਨ੍ਹਾਂ ਦਾ ਮਤਲਬ ਅਰੇਜਮੈਂਟ ਕਰ ਲਿਓ ਅਤੇ ਕੁਰਸੀਆਂ ਵਗੈਰਾ ਦਾ ਵੀ ਐਂ ਨਾ ਹੋਵੇ ਕਿ ਮਤਲਬ ਘੱਟ ਹੋ ਜਾਵੇ ਚਾਹੇ ਵੱਧ ਅਤੇ ਡੀਜੇ ਡੂਜੇ ਦਾ ਸਿਸਟਮ ਠੀਕ ਹੈ ਤੁਸੀਂ ਮੈਨੂੰ ਐਡਰੈਸ ਵੱਟਸ ਵੱਟਸਅੱਪ 'ਤੇ ਸੈਂਡ ਕਰ ਦਿਓ ਮਿਲਕੇ ਗੱਲ ਕਰਦੇ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ